ਹਾਂਜੀ ਪਰਿਵਾਰਾਂ ਦੇ ਵਿੱਚ ਰਸਮਾਂ ਜਿਹੜੀਆਂ ਹੈਗੀਆਂ ਨੇ ਉਹ ਤਿੰਨ ਮੌਕਿਆਂ ਦੇ ਉੱਤੇ ਮੋਟੇ ਤੌਰ 'ਤੇ ਨਿਭਾਈਆਂ ਜਾਂਦੀਆਂ ਜਿਵੇਂ ਜੰਮਣ ਵੇਲੇ ਵਿਆਹ ਵੇਲੇ ਅਤੇ ਮਰਨ ਵੇਲੇ ਤਿੰਨੇ ਮੌਕਿਆਂ ਦੇ ਉੱਤੇ ਖਾਸ ਵਿਸ਼ੇਸ਼ ਰਸਮਾਂ ਜਿਹੜੀਆਂ ਨੇ ਉਹਨਾਂ ਦਾ ਨਿਭਾ ਕੀਤਾ ਜਾਂਦਾ ਜੰਮਣ ਵੇਲੇ ਜਿਹੜਾ ਹੈਗਾ ਉਹ ਬੱਚੇ ਨੂੰ ਅੰਮ੍ਰਿਤ ਛਕਾਇਆ ਜਾਂਦਾ ਅੰਮ੍ਰਿਤ ਛਕਾ ਕੇ ਉਹਦੀ ਜਿਹੜੀ ਹੈਗੀ ਉਹ ਧਰਮ ਦੇ ਵਿੱਚ ਉਹਦੀ ਉਹਦਾ ਦਾਖਲਾ ਹੁੰਦਾ ਵਿਆਹ ਵੇਲੇ ਜਿਹੜਾ ਹੈਗਾ ਆ ਉਹ ਸਾਰੀਆਂ ਰਸਮਾਂ ਨਿਭਾ ਕੇ ਆਨੰਦ ਕਾਰਜ ਦੀ ਰਸਮ ਖ਼ਾਸ ਤੌਰ 'ਤੇ ਮੂਲ ਰੂਪ ਦੇ ਵਿੱਚ ਨਿਭਾਈ ਜਾਂਦੀ ਹੈ ਅਤੇ ਅਕਾਲ ਪੁਰਖ ਤੋਂ ਗੁਰੂ ਮਹਾਰਾਜ ਤੋਂ ਪ੍ਰਵਾਨਗੀ ਲੈ ਕੇ ਜਿਹੜਾ ਹੈਗਾ ਉਹ ਵਿਆਹ ਦੀ ਰਸਮ ਨਿਭਾਈ ਜਾਂਦੀ ਹੈ ਅਤੇ ਰਿਸ਼ਤੇ ਨੂੰ ਪਾਕ ਮੰਨਿਆ ਜਾਂਦਾ ਧਾਰਮਿਕ ਮਾਨਤਾ ਮਿਲਦੀ ਹੈਗੀ ਹੈ ਔਰ ਮਰਨ ਵੇਲੇ ਵੀ ਜਿਹੜਾ ਹੈਗਾ ਉਹ ਉਹ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਦੇ ਭੋਗ ਪਾਏ ਜਾਂਦੇ ਆ ਅਤੇ ਅੰਤਿਮ ਅਰਦਾਸ ਕੀਤੀ ਜਾਂਦੀ ਹੈ ਕੀਰਤਨ ਕੀਤਾ ਜਾਂਦਾ ਔਰ ਤਿਉਹਾਰ ਨੇ ਜਿਹੜੇ ਮੂਲ ਰੂਪ ਦੇ ਵਿੱਚ ਮੋਟੇ ਤੌਰ 'ਤੇ ਜਿਹੜੇ ਹੈਗੇ ਨੇ ਉਹ ਵਿਸਾਖੀ ਲੋਹੜੀ ਵਿਸਾਖੀ ਅਤੇ ਦਿਵਾਲੀ ਜਿਹੜੀ ਹੈਗੀ ਹੈ ਉਹਨੂੰ ਉਤਸ਼ਾਹ ਦੇ ਨਾਲ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਹੈਗਾ ਹੈ